ਹਾਂਜੀ ਬਾਈਕਿੰਗ ਦੀ ਦੁਨੀਆ ਦੇ ਵਿੱਚ ਸਾਡਾ ਸਭ ਤੋਂ ਵੱਡਾ ਰਸਤਾ ਅਤੇ ਰੁਝਾਨ ਆਉਂਦਾ ਹੈ ਮਨੀਕਰਨ ਸਾਹਿਬ ਨੂੰ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸਟੇਟ ਦੇ ਵਿੱਚ ਮੌਜੂਦ ਹੈ ਅਤੇ ਉੱਥੇ ਬਹੁਤ ਵਧੀਆ ਸਾਨੂੰ ਲੱਗਦਾ ਜਦੋਂ ਬਾਈਕ ਦੇ ਉੱਤੇ ਜਾਂਦੇ ਹਾਂ ਉੱਥੇ ਬਹੁਤ ਸੋਹਣੇ ਸੋਹਣੇ ਪਹਾੜ ਰਸਤੇ ਸਾਡੀ ਉਹ ਮੰਜ਼ਿਲ ਹੁੰਦੀ ਆ ਇੱਕ ਬਹੁਤ ਵਧੀਆ ਜਿੱਥੇ ਸਾਨੂੰ ਮਿਲ ਪਹੁੰਚ ਕੇ ਸਕੂਨ ਮਿਲਦਾ ਹੈ ਸ਼ਾਂਤੀ ਹੁੰਦੀ ਹੈ ਅਤੇ ਉਹ ਬਹੁਤ ਵਧੀਆ ਵਾਤਾਵਰਨ ਦੇ ਵਿੱਚ ਉੱਥੇ ਸਾਫ ਸੁਥਰੀ ਹਵਾ ਪਿਓਰ ਸ਼ੁੱਧ ਉੱਥੇ ਆਕਸੀਜਨ ਮਿਲਦੀ ਹੈ ਲੈਂਦੇ ਹਾਂ ਅਤੇ ਜਿਹਦੇ ਵਿੱਚ ਸਾਨੂੰ ਬਹੁਤ ਆਨੰਦ ਅਤੇ ਸ਼ਾਂਤਮਈ ਮਹਿਸੂਸ ਹੁੰਦਾ ਹੈ ਅਤੇ ਅਸੀਂ ਉਸ ਤੋਂ ਬਾਅਦ ਅੱਗੇ ਵੀ ਜਾ ਕੇ ਆਏ ਹਾਂ ਜਿੱਧਰ ਅਸੀਂ ਹੇਮਕੁੰਟ ਸਾਹਿਬ ਵੀ ਗਏ ਸੀਗੇ ਹੇਮਕੁੰਟ ਸਾਹਿਬ ਉੱਥੇ ਬਰਫ ਹੁੰਦੀ ਹੈ ਜਿੱਥੇ ਸਾਡੀ ਮੰਜ਼ਿਲ ਹੈ ਸਾਡਾ ਸਿੱਧਾ ਬਾਈਕ ਉੱਥੇ ਹੀ ਪਹੁੰਚਦਾ ਅਤੇ ਜਾ ਕੇ ਉੱਥੇ ਉਹਨਾਂ ਦੇ ਨਮਸਤਕ ਹੁੰਦੇ ਹਾਂ ਜਿੱਥੇ ਅਸੀਂ ਉੱਥੇ ਅੱਗੇ ਪਿੱਛੇ ਵੀ ਜਾਂਦੇ ਹਾਂ ਘੁੰਮਦੇ ਹਾਂ ਰਵਾਲਸਰ ਸਾਹਿਬ ਵੀ ਜਾ ਕੇ ਆਏ ਹਾਂ ਉਹ ਵੀ ਉੱਥੇ ਬਹੁਤ ਵਧੀਆ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਅਤੇ ਇਹ ਸਾਡੇ ਤਿੰਨ ਚਾਰ ਪੁਆਇੰਟ ਹੈਗੇ ਹਨ ਜਿਹੜੇ ਕਿ ਹਿਮਾਚਲ ਦੇ ਵਿੱਚ ਅਤੇ ਉੱਤਰਾਖੰਡ ਦੇ ਵਿੱਚ ਮੌਜੂਦ ਨੇ ਅਤੇ ਸਾਡੇ ਇਹ ਪੱਕੇ ਮੰਜ਼ਿਲਾਂ ਦੇ ਰਸਤੇ ਨੇ ਜਿਹੜੇ ਸਾਨੂੰ ਉੱਥੇ ਆਪਣੇ ਵੱਲ ਖਿੱਚ ਕੇ ਲੈ ਕੇ ਜਾਂਦੇ ਹਨ